ਹੈਲੋ ਮੇਰਾ ਨਾਮ ਸੰਜਨਾ ਹੈ ਸਾਡਾ ਪੰਜਾਬ ਦਾ ਸੱਭਿਆਚਾਰ ਨਾਚ ਗਿੱਧਾ ਅਤੇ ਭੰਗੜਾ ਹੈਗਾ ਏ ਸਾਡੇ ਵਿਆਹ ਸ਼ਾਦੀਆਂ ਵਿੱਚ ਜ਼ਿਆਦਾਤਰ ਲੋਕ ਜਾਗੋ ਵਿੱਚ ਭੰਗੜੇ ਗਿੱਧਾ ਹੋਰ ਵੀ ਪੰਜਾਬੀ ਸੌਂਗ 'ਤੇ ਬਥੇਰਾ ਲੋਕ ਨੱਚਦੇ ਆ ਅਤੇ ਸਾਡਾ ਮਸ਼ਹੂਰ ਲੋਕ ਨਾਚ ਗਿੱਧਾ ਅਤੇ ਭੰਗੜਾ ਹੀ ਹੈਗਾ ਏ ਜਿਵੇਂ ਕਿ ਸਾਡੇ ਹੁਣ ਕੁਝ ਮੰਥ ਪਹਿਲਾਂ ਸਾਡੇ ਇੱਥੇ ਗੌਰਮਿੰਟ ਸਕੂਲ ਵਿੱਚ ਵੀ ਯੂਥ ਫੈਸਟੀਵਲ ਮਨਾਇਆ ਤਾਂ ਜਿੱਥੇ ਮਤਲਬ ਸ ਹਰ ਇੱਕ ਸਕੋਲ ਸਕੂਲਾਂ ਦੇ ਕੋਲਜ ਦੇ ਬੱਚਿਆਂ ਨੇ ਕਾਫੀ ਉਹਨਾਂ ਨੇ ਭੰਗੜੇ ਭੰਗੜੇ ਵਿੱਚ ਪਾਰਟੀਸਪੇਟ ਕੀਤਾ ਸੀਗਾ ਕੁੜੀਆਂ ਨੇ ਗਿੱਧੇ ਵਿੱਚ ਪਾਰਟੀਸਪੇਟ ਕੀਤਾ ਸੀਗਾ ਉਹਨਾਂ ਨੇ ਕਾਫੀ ਵਧੀਆ ਮਤਲਬ ਕਿ ਬਹੁਤ ਵਧੀਆ ਪਰਫੋਰਮੈਂਸ ਕੀਤਾ ਸੀਗਾ ਕਿ ਗਿੱਧਾ ਭੰਗੜਾ ਭੰਗੜਾ ਉਹਨਾਂ ਦਾ ਇੰਨਾ ਵਧੀਆ ਹੁੰਦਾ ਹੈ ਕਿ ਨਾ ਮਤਲਬ ਜਿਹੜੇ ਦੇਖਦੇ ਆ ਉਹਨਾਂ ਨੂੰ ਵੀ ਇੰਨਾ ਦਿਲ ਕਰਦਾ ਕਿ ਉਹ ਮਤਲਬ ਕਿ ਉੱਥੇ ਜਾ ਕੇ ਆਪ ਵੀ ਨੱਚਣ ਆਪ ਵੀ ਭੰਗੜੇ ਪਾਉਣ ਆਪ ਹੀ ਗਿੱਧਾ ਕਰਨ ਤਾਂ ਫਿਰ ਇਹਨਾਂ ਨਾਲ ਕਿ ਮਤਲਬ ਜਿੱਥੇ ਵੀ ਡੀ ਜੇ ਵਗੈਰਾ ਵੱਜਦਾ ਏ ਕੋਈ ਵੀ ਪ੍ਰੋਗਰਾਮ ਹੁੰਦਾ ਏ ਵਿਆਹ ਸ਼ਾਦੀਆਂ ਵਿੱਚ ਮਤਲਬ ਉਥੇ ਦੇਖਦੇ ਦੇਖਦੇ ਤਾਂ ਮਤਲਬ ਆਪ ਦਾ ਵੀ ਮਨ ਕਰਦਾ ਕਿ ਅਸੀਂ ਵੀ ਮਤਲਬ ਕਿ ਭੰਗੜੇ ਪਾਈਏ ਗਿੱਧਾ ਪਾਈਏ ਅਸੀਂ ਵੀ ਨਾਲੇ ਉਹਨਾਂ ਦੇ ਰਲ ਜਾਈਏ ਤਾਂ ਇਸ ਨਾਲ ਨਾ ਮਤਲਬ ਕਿ ਸਾਡੇ ਸਾਡੇ ਪਿੰਡ ਵਿੱਚ ਕੁਝ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਏ ਜ਼ਿਆਦਾਤਰ ਸਾਡੇ ਪਿੰਡ ਦੇ ਮਤਲਬ ਕਿ ਆਲੇ ਦੁਆਲੇ ਈ ਹੁੰਦਾ ਜ਼ਿਆਦਾਤਰ ਤਾਂ ਅਸੀਂ ਉਥੇ ਮਤਲਬ ਡੀ ਜੇ ਲੱਗਦੇ ਆ ਸਾਡੇ ਸਾਨੂੰ ਜਦੀ ਦਿਲ ਕਰਦਾ ਕਿ ਅਸੀਂ ਉੱਥੇ ਜਾਈਏ ਅਤੇ ਨਾਲੇ ਉੱਥੇ ਅਸੀਂ ਭੰਗੜਾ ਕਰੀਏ